ਪਹਿਲਾਂ ਪਾਣੀ ਦੇ ਸਰੋਤ ਬਹੁਤ ਘੱਟ ਸਨ ਉਹਨਾਂ ਦੇ ਵਿੱਚੋਂ ਕੁਝ ਸਾ ਕੁਝ ਸਰੋਤ ਜਿਵੇਂ ਕਿ ਛੱਪੜ ਖੂਹ ਆਦਿ ਹੁੰਦੇ ਸਨ ਅਤੇ ਉਹਨਾਂ ਵਿੱਚੋਂ ਖੂਹ ਸਭ ਤੋਂ ਮੁੱਖ ਸਰੋਤ ਹੈ ਜਿਸ ਵਿੱਚ ਜਿਸ ਦੀ ਵਰਤੋਂ ਲੋਕ ਆਂ ਪਾਣੀ ਲੈ ਕੇ ਆਉਣ ਲਈ ਕਰਦੇ ਸਨ ਉਹ ਪ ਇੱਕ ਬਾਲਟੀ ਦੀ ਨੂੰ ਬਾਲਟੀ ਨੂੰ ਰੱਸੀ ਬੰਨ੍ਹ ਕੇ ਅਤੇ ਉਸਨੂੰ ਖੂਹ ਵਿੱਚ ਸੁੱਟ ਦਿੰਦੇ ਸਨ ਅਤੇ ਉਸ ਤੋਂ ਬਾਅਦ ਉਸ ਨੂੰ ਉੱਤੇ ਖਿੱਚ ਲੈਂਦੇ ਸਨ ਜਿਸ ਵਿੱਚ ਪਾਣੀ ਆ ਜਾਂਦਾ ਸੀ ਅਤੇ ਉਹ ਉਸਨੂੰ ਘੜੇ ਵਿੱਚ ਭਰ ਕੇ ਅਤੇ ਘਰ ਲਿਆਉਂਦੇ ਸਨ ਅਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਜਮਾਨਾ ਬਦਲਿਆ ਉਵੇਂ ਉਵੇਂ ਉਹ ਹੁਣ ਇਲੈਕਟਰਿਕ ਮੋਟਰ ਦੀ ਵਰਤੋਂ ਕਰਨ ਲੱਗੇ ਉਹ ਇਲੈਕਟਰਿਕ ਮੋਟਰ ਦੀ ਵਰਤੋਂ ਇਸ ਪ੍ਰਕਾਰ ਕਰਦੇ ਸਨ ਉਹ ਸਭ ਤੋਂ ਪਹਿਲਾਂ ਧਰਤੀ ਦੇ ਵਿੱਚ ਇੱਕ ਛੇ ਇੱਕ ਗਹਿਰਾ ਖੱਡਾ ਕਰ ਲੈਂਦੇ ਸਨ ਜਿਸ ਵਿੱਚ ਪਾਈਪ ਪਾ ਕੇ ਉਹ ਉੱਤੋਂ ਦੀ ਬਿੱਲ ਲਈ ਮੋਟਰ ਦੇ ਨਾਲ ਕਨੈਕਸ਼ਨ ਕਰ ਲੈਂਦੇ ਸਨ ਅਤੇ ਉਸ ਕਨੈਕਸ਼ਨ ਰਾਹੀਂ ਉਹ ਪਾਣੀ ਉੱਤੇ ਖਿੱਚ ਲੈਂਦੇ ਸਨ ਇਲੈਕਟਰਿਕ ਮੋਟਰ ਦੇ ਨਾਲ ਪਾਣੀ ਕੱਢਣਾ ਬਹੁਤ ਆਸਾਨ ਹੋ ਗਿਆ ਹੈ ਜਿਵੇਂ ਜਿਵੇਂ ਜਮਾਨਾ ਬਦਲ ਰਿਹਾ ਉਵੇਂ ਉਵੇਂ ਤਰੱਕੀ ਹੋ ਰਹੀ ਹੈ ਜਿਵੇਂ ਪਹਿਲਾਂ ਲੋਕ ਬਹੁਤ ਮੁਸ਼ਕਲ ਕਰਦੇ ਅਤੇ ਮਿਹਨਤ ਕਰਕੇ ਪਾਣੀ ਲੈ ਕੇ ਆਉਂਦੇ ਸਨ ਪਰ ਹੁਣ ਉਹ ਇੱਕ ਵੀ ਇੱਕ ਮੋਟਰ ਦਾ ਸਵਿਚ ਆਨ ਕਰਕੇ ਪਾਣੀ ਨਾਲ ਨ ਕੱਢ ਸਕਦੇ ਹਨ ਅਤੇ ਆਪਣੀ ਲੋੜ ਅਨੁਸਾਰ ਵਰਤ ਸਕਦੇ ਹਨ ਅਤੇ ਉਹ ਹੁਣ ਜਿਵੇਂ ਇਸ ਮੋਟਰ ਵੀ ਵੱਖ ਵੱਖ ਪ੍ਰਕਾਰ ਦੀ ਹੈ ਜਿਵੇਂ ਆਮ ਘਰਾਂ ਦੇ ਵਿੱਚ ਛੋਟੀ ਮੋਟਰ ਹੁੰਦੀ ਹੈ ਪਰ ਅ ਜਿਵੇਂ ਖੇਤ ਵਗੈਰਾ ਦੇ ਵਿੱਚ ਮੱਛੀ ਮੋਟਰ ਲੱਗੀ ਹੁੰਦੀ ਹੈ ਜੋ ਕਿ ਬਹੁਤ ਜ਼ਿਆਦਾ ਵੱਡੀ ਅ ਤਾਕਤਵਰ ਮੋਟਰ ਹੁੰਦੀ ਹੈ ਜਿਸਦੀ ਰਾਹੀਂ ਪਾਣੀ ਬਹੁਤ ਜ਼ਿਆਦਾ ਕੈਪੈਸਿਟੀ ਦੇ ਵਿੱਚ ਬਾਹਰ ਆ ਸਕਦਾ ਹੈ ਇਸ ਲਈ ਲੋਕ ਆਪਣੇ ਹਿਸਾਬ ਨਾਲ ਪਾਣੀ ਮ ਮੋਟਰ ਦੀ ਵਰਤੋਂ ਕਰਕੇ ਪਾਣੀ ਬਾਹਰ ਕੱਢ ਸਕਦੇ ਹਨ